ਇਹ ਜਿਹੜਾ ਮਸ਼ੀਨੀ ਕੰਮ ਆ ਮੈਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਬਹੁਤ ਮੈਂ ਮੱਥਾ ਮਾਰਦੀ ਰਹਿੰਦੀ ਹਾਂ ਕਰਦੀ ਰਹਿੰਦੀ ਹਾਂ ਅਤੇ ਵੀ ਵਧੀਆ ਮਸ਼ੀਨ ਹੋਵੇ ਜਿਹੜੀ ਮੋਟਰ ਵਾਲੀ ਮਸ਼ੀਨ ਹੈ ਅਤੇ ਉਹਦੇ ਉੱਤੇ ਸਿਲਾਈ ਵਧੀਆ ਹੋ ਜਾਂਦੀ ਹੈ ਛੇਤੀ ਹੋ ਜਾਂਦੀ ਹੈ ਮਿਹਨਤ ਘੱਟ ਹੁੰਦੀ ਹੈ ਅਤੇ ਇੱਕ ਵਾਰ ਫਰਾਕ ਮੋਬਾਈਲ ਦੇ ਵਿੱਚ ਆ ਗਈ ਅਤੇ ਮੇਰੀ ਦੋਹਤੀ ਨੇ ਮੈਨੂੰ ਉਹ ਡਿਜ਼ਾਇਨ ਵਿਖਾਇਆ ਵੀ ਨਾਨੀ ਇਸ ਤਰ੍ਹਾਂ ਦੀ ਮੈਂ ਫਰਾਕ ਪਾਉਣੀ ਹੈ ਅਤੇ ਪਰ ਮੈਨੂੰ ਬਹੁਤ ਮੁਸ਼ਕਿਲ ਆਈ ਉਹਦੇ ਵਿੱਚ ਬਣਾਉਣ ਦੀ ਅਤੇ ਮੈਂ ਪੰਜ ਛੇ ਘੰਟੇ ਲੱਗ ਗਏ ਅਤੇ ਪਰ ਮੈਂ ਬਣਾ ਲਈ ਬਣਾ ਕੇ ਅਤੇ ਫਿਰ ਉਹ ਦੋਹਤੀ ਨੇ ਪਾਈ ਅਤੇ ਬੜਾ ਉਹਦਾ ਮਨ ਖੁਸ਼ ਹੋਇਆ ਅਤੇ ਪਰ ਬਣਾ ਤਾਂ ਮੈਂ ਲਈ ਪਰ ਬਹੁਤ ਮੁਸ਼ਕਿਲ ਨਾਲ ਬਣਾਈ ਪੰਜ ਛੇ ਘੰਟਿਆਂ ਦੇ ਵਿੱਚ ਅਤੇ ਇਹ ਜਿਹੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਹੈ ਅਤੇ ਚੱਲੋ ਜੇ ਅ ਮੌਬਾਇਲ ਚੋਂ ਆਉਂਦੀਆ ਤਾਂ ਵੀ ਉਹ ਵੀ ਅਸੀਂ ਚੁੱਕ ਕੇ ਬਣਾ ਲੈਂਦੇ ਹਾਂ ਜੇ ਨਹੀਂ ਮੋਬਾਇਲ 'ਚ ਤਾਂ ਅਸੀਂ ਕਿਸੇ ਆਂਢ ਗੁਆਂਢ ਦੇ ਘਰ ਜਾ ਕੇ ਆਪਣਿਆਂ ਘਰਾਂ 'ਚ ਜਾ ਕੇ ਅਤੇ ਦੱਸ ਕਰਕੇ ਅਤੇ ਅਸੀਂ ਜਿਹੜਾ ਵੀ ਕੰਮ ਆ ਅਸੀਂ ਵੇਖਨੇ ਹਾਂ ਅਤੇ ਉਹ ਪੁੱਛ ਕੇ ਜਾਂ ਵੇਖ ਕੇ ਅਸੀਂ ਕਰ ਲੈਂਦੇ ਹਾਂ ਅਤੇ ਕਰਕੇ ਤਾਂ ਸਾਨੂੰ ਬਹੁਤ ਇਸ ਗੱਲ ਦੇ ਵਿੱਚ ਖੁਸ਼ੀ ਹੁੰਦੀ ਹੈ ਅਤੇ ਆਪਣੇ ਜਿਹੜੇ ਕੰਮ ਹੈ ਅਸੀਂ ਬਹੁਤ ਮਸ਼ੀਨੀ ਵੀ ਕਰਦੇ ਹੈ ਕਰਕੇ ਅਤੇ ਆਪਣਾ ਵਧੀਆ ਟਾਈਮ ਪਾਸ ਕਰ ਲੈਂਦੇ ਹਾਂ